ਹਾਂਜੀ ਸਰ ਮੈਂ ਮੈਨੂੰ ਬਿਜਲੀ ਦਾ ਕੰਮ ਕਰਦੇ ਨੂੰ ਤਕਰੀਬਨ ਸੱਤ ਅੱਠ ਸਾਲ ਹੋ ਗਏ ਅਤੇ ਮੈਂ ਬਿਜਲੀ ਦਾ ਕੰਮ ਆਪਣੇ ਚਾਚਾ ਜੀ ਤੋਂ ਸਿੱਖਿਆ ਸੀ ਜਿਵੇਂ ਕਿ ਘਰ ਦੀ ਫਿਟਿੰਗ ਹੋ ਗਈ ਉਹ ਵੀ ਕਰ ਦਿੰਦੇ ਹਾਂ ਕੂਲਰ ਠੀਕ ਕਰ ਦਿੰਦੇ ਹਾਂ ਪੱਖੇ ਜੀ ਘਰ ਦੀ ਆਪਣਾ ਸ਼ੀਟਾਂ ਲਗਾ ਦਿੰਦੇ ਹਾਂ ਵੈਲਡਿੰਗ ਹੋ ਗਈ ਸਾਰਾ ਕੁਛ ਅਵੇਲੇਬਲ ਹੈ ਸਾਡੇ ਕੋਲ ਅਸੀਂ